ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਪੰਜਾਬ ਵਿੱਚ ਮੁੱਖ ਫਸਲਾਂ ਉਗਾਈ ਜਾਂਦੀਆਂ ਹਨ ਜਿਵੇਂ ਕਿ ਚਾਵਲ ਗੰਨਾ ਕਣਕ ਦਾਲਾਂ ਫਲ ਅਤੇ ਅਨਾਜ ਇਹ ਇੱਦਾਂ ਉਗਾਏ ਜਾਂਦੇ ਹਨ ਕਿ ਜਿਵੇਂ ਕਿ ਅਨਾਜ ਦਾ ਬੀਜ਼ ਅਸੀਂ ਮਿੱਟੀ ਵਿੱਚ ਪਾਇਆ ਅਤੇ ਉਹਨੂੰ ਪਾਣੀ ਦਿੱਤਾ ਤੇ ਅਤੇ ਉਸ ਵਿੱਚ ਕਈ ਪਦਾਰਥ ਪਾਏ ਉਹਨੂੰ ਉਗਾਉਣ ਵਾਸਤੇ ਅਤੇ ਅਸੀਂ ਉਸਨੂੰ ਧੁੱਪ ਲਵਾਈ ਦੋ ਤਿੰਨ ਦਿਨ ਅਤੇ ਉਹਨੂੰ ਅੱਛੇ ਤਰੀਕੇ ਨਾਲ ਉਗਾਇਆ ਅਤੇ ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਕੱਟਿਆ ਅਤੇ ਉਸਨੂੰ ਬੋਰੀਆਂ ਵਿੱਚ ਪਾਇਆ ਅਤੇ ਫਿਰ ਜੋ ਲੋਕ ਹੁੰਦੇ ਆ ਸਬਜ਼ੀ ਮੰਡੀ ਵਾਲੇ ਉਹ ਉਹਨੂੰ ਲੋਕ ਜੋ ਫਾਰਮਰ ਹੁੰਦੇ ਆ ਉਹ ਉਹਨੂੰ ਵੇਚ ਦਿੰਦੇ ਹਨ ਅਤੇ ਉਸ ਤੋਂ ਪੈਸਾ ਕਮਾਉਂਦੇ ਹਨ ਅਤੇ ਇੱਦਾਂ ਹੀ ਬਾਕੀ ਫਸਲਾਂ ਵੀ ਇੱਦਾਂ ਹੀ ਉਗਾਈਆਂ ਅਤੇ ਕੱਟੀਆਂ ਜਾਂਦੀਆਂ ਹਨ ਅਤੇ ਬਾਜ਼ਾਰਾਂ ਵਿੱਚ ਭੇਜੀਆਂ ਜਾਂਦੀਆਂ ਹਨ